ਪੌਦੇ ਉਗਾਉਣ ਲਈ ਸਭ ਤੋਂ ਵਧੀਆ ਮਿੱਟੀ ਹੁੰਦੀ ਹੈ ਜਲੋੜ੍ਹ ਮਿੱਟੀ ਉਹ ਮਿੱਟੀ ਹੁੰਦੀ ਹੈ ਜਿਹੜੀ ਦਰਿਆਵਾਂ ਆਪਣੇ ਨਾਲ ਲੈ ਕੇ ਆਉਂਦੇ ਹਨ ਅਤੇ ਉਹ ਸਭ ਤੋਂ ਜ਼ਿਆਦਾ ਉਪਜਾਊ ਹੁੰਦੀ ਹੈ ਜੇ ਜੇਕਰ ਆਪਾਂ ਜਲੋੜ੍ਹ ਮਿੱਟੀ ਦਾ ਯੂਜ ਕਰੀਏ ਤਾਂ ਉਸ ਉਸ ਮਿੱਟੀ ਨੂੰ ਉਸ ਮਿੱਟੀ ਦਾ ਇਸਤੇਮਾਲ ਕਰ ਕੇ ਸਭ ਤੋਂ ਵਧੀਆ ਤਰੀਕੇ ਨਾਲ ਸਾਡੇ ਪੌਦੇ ਜਿਹੜੇ ਹੈ ਉਹ ਵਧਦੇ ਹਨ ਜੇਕਰ ਆਪਾਂ ਕੋਈ ਹੋਰ ਜਿਹੜੀ ਜਿਹੜੀ ਮਿੱਟੀ ਘੱਟ ਉਪਜਾਊ ਹੁੰਦੀ ਹੈ ਜੇਕਰ ਆਪਾਂ ਉਸ ਮਿੱਟੀ ਦਾ ਉਪਯੋਗ ਕਰੀਏ ਤਾਂ ਉਹ ਕੰਪੈਰੇਟਿਵਲੀ ਘੱਟ ਪੌਦਾ ਵੱਧਦਾ ਹੈ ਅਤੇ ਜਿਹੜੀ ਜਲੋੜ੍ਹ ਮਿੱਟੀ ਵਿੱਚ ਉਗਾਇਆ ਪੌਦਾ ਹੈ ਉਹ ਵਧੀਆ ਤਰੀਕੇ ਨਾਲ ਗਰੋ ਕਰਦਾ ਹੈ ਜਲੋੜ੍ਹ ਮਿੱਟੀ ਵਿੱਚ ਸੈਵਨਟੀ ਟੂ ਏਟੀ ਪਰਸੈਂਟ ਨਾਈਟ੍ਰੋਜਨ ਦੀ ਮਾਤਰਾ ਹੁੰਦੀ ਹੈ ਜਿਸ ਜਿਹੜੀ ਸਭ ਤੋਂ ਮੇਨ ਰੀਜਨ ਹੈ ਜਿਸ ਕਰਕੇ ਸਾਡੇ ਪੇੜ ਪੌਦੇ ਜਿਹੜੇ ਆ ਉਹ ਵਧੀਆ ਤਰੀਕੇ ਨਾਲ ਗ ਗਰੋ ਕਰਦੇ ਆ ਅਤੇ ਜੇ ਗੱਲ ਆਵੇ ਸਾਡੀ ਖਾਦ ਦੀ ਤਾਂ ਖਾਦ ਆਪਾਂ ਜਿ ਜਿਹੜੀ ਦੇਸੀ ਖਾਦ ਹੁੰਦੀ ਆ ਆਪਾਂ ਉਹ ਵਰਤਦੇ ਹਾਂ ਸੋ ਦੈਟ ਸਾਡੀ ਜਿਹੜੀ ਸਾਡੇ ਜਿਹੜੇ ਪੇੜ ਪੌਦੇ ਆ ਉਹ ਗਰੋ ਕਰਨ ਹੁਣ ਜਿਹੜੀ ਖਾਦ ਆ ਕਈ ਵਾਰੀ ਘਰਦੇ ਜਿਹੜੇ ਹੁੰਦੇ ਆ ਘਰੇਲੂ ਨੁਸਖੇ ਨਾਲ ਵੀ ਵਰਤਦੇ ਹਾਂ ਜਿਵੇਂ ਕਿ ਕੇਲੇ ਦੇ ਛਿਲਕਿਆਂ ਨੂੰ ਖਾਦ ਖਾਦ ਦੇ ਇਸਤੇਮਾਲ ਲਈ ਵਰਤਦੇ ਹਾਂ ਅਤੇ ਇਸ ਤਰੀਕੇ ਨਾਲ ਉਹ ਕੰਮ ਆਉਂਦੀ ਹੈ